ਅੱਜ ਕੱਲ੍ਹ ਦਾ ਯੁੱਗ ਤੈਕਨੋਲਜੀ ਦਾ ਯੁੱਗ ਹੈ ਜਿਸ ਵਿੱਚ ਸਭ ਤੋਂ ਬੜਾ ਮਾਧਿਅਮ ਹੈਗਾ ਇੰਟਰਨੈੱਟ ਜਿਸ ਰਾਹੀ ਅਸੀਂ ਕਈ ਕੰਮ ਕਰਦੇ ਹਾਂ ਕਈ ਰੁਜ਼ਗਾਰ ਹੈ ਜਿਹੜੇ ਇਹਦੇ ਨਾਲ਼ ਜੁੜੇ ਵੇ ਜਿੱਦਾਂ ਬੈਂਕਾਂ ਵਿੱਚ ਕੰਮ ਹੁੰਦੇ ਨੇ ਪੋਸਟ ਓਫ਼ਿਸਾਂ 'ਚ ਕੰਮ ਹੁੰਦੇ ਹਨ ਸਾਰਾ ਕੁਝ ਔਨਲਾਈਨ ਹੋ ਗਿਆ ਅੱਜ ਕੱਲ੍ਹ ਸਾਰੇ ਕਿੱਤੇ ਜਿਹੜੇ ਹੈ ਕਿਸੇ ਛੋਟੇ ਤੋਂ ਛੋਟੇ ਦਫ਼ਤਰ ਵਿੱਚ ਵੀ ਚਲ ਜਾਓ ਹਰ ਦਫ਼ਤਰ ਵਿੱਚ ਔਨਲਾਈਨ ਹੀ ਕੰਮ ਹੁੰਦਾ ਹੈ ਅੱਜ ਕੱਲ੍ਹ ਨੌਕਰੀਆਂ ਦੇ ਜਿਹੜੇ ਮੈਸਿਜ ਹੈ ਪਹਿਲਾਂ ਡਾਕ ਦੁਆਰਾ ਆਉਂਦੇ ਸੀ ਅੱਜ ਈਮੇਲ ਰਾਹੀਂ ਵੱਟਸਅੱਪ ਰਾਹੀਂ ਸਭ ਕੁਝ ਔਨਲਾਈਨ ਚੱਲ ਰਿਹਾ ਹੈ ਸੋ ਟੈਕਨੋਲਜੀ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਹੁਣ ਸਮੇਂ ਨਾ ਹੋਣ ਕਾਰਨ ਈਮੀਡੇਟ ਕੋਈ ਵੀ ਕੰਮ ਯਾਨੀ ਕਿ ਜਲਦ ਤੋਂ ਜਲਦ ਹੁੰਦਾ ਆ ਜਿੱਦਾਂ ਕਿ ਹੁਣ ਤੁਹਾਨੂੰ ਮੈਂ ਦੱਸਿਆ ਹੀ ਹੈ ਕਿ ਪਹਿਲਾਂ ਲੈਟਰਸ ਆਉਂਦੇ ਹੁੰਦੇ ਸੀਗੇ ਤੁਹਾਡੇ ਏ ਕਿਸੇ ਵੀ ਨੌਕਰੀ ਲਈ ਤੁਸੀਂ ਇੰਟਰਵਿਊ ਦੇਣਾ ਹੈ ਉਹਦੇ ਲਈ ਲੈਟਰ ਆਉਂਦਾ ਹੁੰਦਾ ਸੀ ਲੇਕਿਨ ਹੁਣ ਉਹ ਮੇਲ ਰਾਹੀਂ ਤੁਹਾਨੂੰ ਇੰਨਵੀਟੇਸ਼ਨ ਭੇਜ ਦਿੰਦੇ ਨੇ ਪ੍ਰਿ ਤੁਸੀਂ ਪ੍ਰਿੰਟ ਕਰਕੇ ਉਹਨੂੰ ਲੈ ਜਾਂਦੇ ਹੋ ਸੋ ਤੈਕਨੋਲਜੀ ਅੱਜ ਕੱਲ੍ਹ ਬਹੁਤ ਤਰੱਕੀ ਕਰ ਰਹੀ ਹੈ ਇਸ ਕਾ ਦਾ ਸਾਨੂੰ ਬਹੁਤ ਫਾਇਦਾ ਆ ਅਸੀਂ ਅੱਜ ਕੱਲ੍ਹ ਬੈਠੇ ਬੈਠੇ ਘਰ ਬੈਠੇ ਪੈਸੇ ਕਿਸੇ ਨੂੰ ਵੀ ਟ੍ਰਾਂਸਫਰ ਕਰ ਸਕਦੇ ਹੋ ਔਨਲਾਈਨ ਤੈਕਨੋਲਜੀ ਬਹੁਤ ਸਾਨੂੰ ਸੁਵਿਧਾਵਾਂ ਦੇ ਰਹੀ ਹੈ ਅਤੇ ਕਈ ਐਸੇ ਕੌਰਸ ਹਨ ਜਿਹੜੇ ਵਿਦਿਆਰਥੀ ਉਹਨੂੰ ਜਾਰੀ ਰੱਖਣਾ ਚਾਹੁੰਦੇ ਨੇ ਜਿੱਦਾਂ ਕਿ ਬੀ ਸੀ ਏ ਹੈ ਬੈਚਲਰ ਔਫ ਕੰਪਿਊਟਰ ਐਪਲੀਕੇਸ਼ਨਸ ਕਈ ਇੱਦਾਂ ਦੇ ਹੈ ਬੀ ਟੈਕ ਹੈ ਜਿੰਨੇ ਵੀ ਹੈਗਾ ਸਭ ਉਹਨੇ ਕੰਪਿਊਟਰ ਨਾਲ਼ ਜੁੜੇ ਕਿੱਤੇ ਨੇ ਅਤੇ ਸਭ ਇਹਨਾਂ ਨੂੰ ਸਾਨੂੰ ਜਾਰੀ ਵੀ ਰੱਖਣਾ ਚਾਹੀਦਾ ਹੈ